ਪਾਣੀ ਜੀਵਨ ਲਈ ਜ਼ਰੂਰੀ ਹੈ ਅਤੇ ਸਾਡੇ ਸਰੀਰ ਵੱਖ ਵੱਖ ਕਾਰਜਾਂ ਲਈ ਇਸ 'ਤੇ ਨਿਰਭਰ ਕਰਦੇ ਹਨ ਕਿਉਂਕਿ ਮਨੁੱਖੀ ਸਰੀਰ ਦਾ ਲਗਭਗ ਸੱਠ ਪ੍ਰਸੈਂਟ ਹਿੱਸਾ ਪਾਣੀ ਨਾਲ ਬਣਿਆ ਹੈ ਇਸ ਲਈ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਹਾਈਡਰੇਟਡ ਰਹਿਣਾ ਬਹੁਤ ਜ਼ਰੂਰੀ ਹੈ ਇੱਥੇ ਕੁਝ ਮੁੱਖ ਕਾਰਨ ਹਨ ਕਿ ਰੋਜ਼ਾਨਾ ਪਾਣੀ ਪੀਣਾ ਮਹੱਤਵਪੂਰਨ ਹੈ ਜਿਵੇਂ ਕਿ ਹਾਈਡਰੇਸ਼ਨ ਬਣਾਈ ਰੱਖਦਾ ਹੈ ਪਾਣੀ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਇਹ ਯਕੀਨੀ ਬਣਾਉਂਦਾ ਹੈ ਕਿ ਸੈੱਲ ਟਿਸ਼ੂ ਅਤੇ ਅੰਗ ਸਹੀ ਢੰਗ ਨਾਲ ਕੰਮ ਕਰਦੇ ਹਨ ਪਾਚਨ ਅਤੇ ਪੋਸ਼ਕ ਤੱਤਾਂ ਨੂੰ ਸੋਖਣ ਵਿੱਚ ਸਹਾਇਤਾ ਕਰਦਾ ਹੈ ਇਹ ਭੋਜਨ ਨੂੰ ਤੋੜਨ ਅਤੇ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਦਾ ਹੈ ਪਾਣੀ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਅਤੇ ਰਹਿੰਦ ਖੂੰਹਦ ਨੂੰ ਖਤਮ ਕਰਕੇ ਗੁਰਦੇ ਅਤੇ ਜਿਗਰ ਦੇ ਕੰਮ ਦਾ ਸਮਰਥਨ ਕਰਦਾ ਹੈ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ ਡੀਹਾਈਡਰੇਸ਼ਨ ਥਕਾਵਟ ਅਤੇ ਚੱਕਰ ਆਉਣ ਦਾ ਕਾਰਨ ਬਣ ਸਕਦੀ ਹੈ ਕਾਫੀ ਪਾਣੀ ਪੀਣ ਨਾਲ ਊਰਜਾ 'ਤੇ ਧਿਆਨ ਕੇਂਦਰਿਤ ਰਹਿਣ ਵਿੱਚ ਮਦਦ ਮਿਲਦੀ ਹੈ ਦਿਮਾਗੀ ਕਾਰਜ ਵਿੱਚ ਸੁਧਾਰ ਕਰਦਾ ਹੈ ਸਹੀ ਹਾਈਡਰੇਸ਼ਨ ਯਾਦਾਸ਼ਤ ਇਕਾਗਰਤਾ ਅਤੇ ਮੂੜ ਨੂੰ ਵਧਾਉਂਦਾ ਹੈ ਜਿਵੇਂ ਕਿ ਤਣਾਅ ਅਤੇ ਚਿੰਤਾ ਨੂੰ ਘਟਾਉਂਦਾ ਹੈ ਸਿਹਤਮੰਦ ਚਮੜੀ ਨੂੰ ਉਤਸ ਉਤਸ਼ਾਹਿਤ ਕਰਦਾ ਹੈ ਪਾਣੀ ਪੀਣ ਨਾਲ ਚਮੜੀ ਨੂੰ ਹਾਈਡਰੇਟਿਡ ਰੱਖਣ ਦੇ ਵਿੱਚ ਮਦਦ ਮਦਦ ਮਿਲਦੀ ਹੈ ਖੁਸ਼ਕੀ ਅਤੇ ਝੁਰੜੀਆਂ ਘੱਟ ਹੁੰਦੀਆਂ ਹਨ ਸਰੀਰ ਦਰਦ ਵਿੱਚ ਮਾਈਗ੍ਰੇਸ਼ਨ ਨੂੰ ਰੋਕਦਾ ਹੈ ਸਰੀਰ ਦਰਦ ਦੇ ਸਭ ਤੋਂ ਆਮ ਕਾਰਨ ਵਿੱਚੋਂ ਇੱਕ ਡੀਹਾਈਡਰੇਸ਼ਨ ਹੈ ਪਾਣੀ ਪੀਣਾ ਇਹਨਾਂ ਨੂੰ ਰੋਕਣਾ ਅਤੇ ਰਾਹਤ ਦੇਣ ਵਿੱਚ ਮਦਦ ਕਰਦਾ ਹੈ ਭਾਰ ਪ੍ਰਬੰਧਨ ਵਿੱਚ ਸਹਾਇਤਾ ਕਰਦਾ ਹੈ ਪਾਣੀ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਅਤੇ ਭਰਪੂਰਨ ਦੀ ਭਾਵਨਾ ਪੈਦਾ ਕਰਦਾ ਹੈ ਜ਼ਿਆਦਾ ਖਾਣ ਤੋਂ ਰੋਕਦਾ ਹੈ ਜੋੜਾਂ ਅਤੇ ਮਾਸਪੇਸ਼ੀਆਂ ਨੂੰ ਲੁਬਰੀਕੇਡ ਕਰਦਾ ਹੈ ਖੂਨ ਸੰਚਾਰ ਅਤੇ ਦਿਲ ਦੀ ਸਿਹਤ ਨੂੰ ਨਿਯੰਤਰਿਤ ਕਰਦਾ ਹੈ